ਸਾਡੇ ਖੇਤਰ ਵਿੱਚ ਕਲਾ ਅਤੇ ਸ਼ਿਲਪਕਾਰੀ ਖੇਤਰ ਰਾਜ ਦੇ ਹੋਰ ਖੇਤਰਾਂ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ ਜਿਵੇਂ ਫੈਸ਼ਨ ਕੋਈ ਵੀ ਰਾਜ ਦਾ ਫੈਸ਼ਨ ਅਸੀਂ ਅਪਣਾ ਰਹੇ ਹਾਂ ਅਤੇ ਉਹ ਆਪਣਾ ਫੈਸ਼ਨ ਅਪਣਾ ਰਹੇ ਹਨ ਜਿਵੇਂ ਕੱਪੜੇ ਪਾਉਣ ਦਾ ਤੌਰ ਤਰੀਕਾ ਖਾਣ ਪੀਣ ਦੀ ਸਮਗਰੀ ਰਹਿਣਾ ਸਹਿਣਾ ਇਸ ਕਾਰਨ ਫੈਸ਼ਨ ਵੀ ਇੱਕ ਰਾਜ ਤੋਂ ਦੂਜੇ ਰਾਜ ਤੱਕ ਪ੍ਰਭਾਵਿਤ ਹੋ ਰਿਹਾ ਹੈ ਡਿਜਾਇਨ ਅਲੱਗ ਅਲੱਗ ਡਿਜਾਇਨ ਦੇ ਕੱਪੜੇ ਮਿੱਟੀ ਦੇ ਬਰਤਨ ਭਾਂਡੇ ਅਲਮਾਰੀ ਫਰਨੀਚਰ ਦਾ ਸਮਾਨ ਵੀ ਅਸੀਂ ਦੂਜੇ ਰਾਜਾਂ ਦਾ ਕਾਪੀ ਕਰ ਰਹੇ ਹਾਂ ਇਸ ਤਰ੍ਹਾਂ ਵੱਖ ਵੱਖ ਡਿਜਾਈਨ ਕੱਪੜਿਆਂ ਦਾ ਡਿਜ਼ਾਇਨ ਵੀ ਅਸੀਂ ਦੂਸਰੇ ਰਾਜਾਂ ਦੀ ਤਰ੍ਹਾਂ ਬਦਲ ਰਹੇ ਹਾਂ ਅਤੇ ਦੂਜੇ ਰਾਜ ਵੀ ਆਪਣੇ ਰਾਜ ਦੀ ਤਰ੍ਹਾਂ ਤਬਦੀਲੀਆਂ ਲਿਆ ਰਹੇ ਹਨ ਇਸ਼ਤਿਹਾਰਬਾਜ਼ੀ ਇਸ਼ਤਿਹਾਰਬਾਜ਼ੀ ਸਾਡੇ ਰਾਜ ਨੂੰ ਬਹੁਤ ਪ੍ਰਭਾਵਿਤ ਕਰ ਰਹੀ ਹੈ ਅਸੀਂ ਇਸ਼ਤਿਹਾਰ ਰਾਹੀਂ ਨਵੇਂ ਨਵੇਂ ਚੀਜ਼ਾਂ ਬਾਰੇ ਜਾਣਕਾਰੀ ਹਾਸਿਲ ਕਰ ਰਹੇ ਹਾਂ ਅਤੇ ਉਹਨਾਂ ਨੂੰ ਬਣਾਉਣ ਦੇ ਤਰੀਕੇ ਵੀ ਕਾਪੀ ਕਰ ਰਹੇ ਹਾਂ ਨਵੀਆਂ ਨਵੀਆਂ ਚੀਜ਼ਾਂ ਤੋਂ ਵੀ ਜਾਣੂ ਹੋ ਰਹੇ ਹਾਂ ਫਿਲਮ ਫਿਲਮਾਂ ਵਿੱਚ ਬਹੁਤ ਤਰ੍ਹਾਂ ਦੇ ਫੈਸ਼ਨ ਡਿਜਾਈਨ ਇਸ਼ਤਿਹਾਰਬਾਜ਼ੀ ਭੋਜਨ ਆਦਿ ਦਿਖਾਇਆ ਜਾਂਦਾ ਹੈ ਤਾਂ ਅਸੀਂ ਉਹਨਾਂ ਨੂੰ ਦੇਖ ਕੇ ਵੀ ਬਹੁਤ ਪ੍ਰਭਾਵਿਤ ਹੁੰਦੇ ਹਾਂ ਇਸ ਤਰ੍ਹਾਂ ਇੱਕ ਰਾਜ ਦੂਜੇ ਰਾਜ ਨੂੰ ਵੱਖ ਵੱਖ ਤਰ੍ਹਾਂ ਨਾਲ ਪ੍ਰਭਾਵਿਤ ਕਰਦਾ ਹੈ